ਬਰਫੀ ਕਲਾਕੰਦ ਕਾਜੂ ਕਤਲੀ ਰਸਗੁੱਲਾ ਰਸਮਲਾਈ ਸ਼ਾਹੀ ਟੁਕੜਾ ਖੀਰ ਖੁਬਾਨੀਅਤ ਕਾ ਮੀਠਾ ਮੈਸੂਰ ਪਾਕ ਗੁਲਾਬ ਜਾਮੁਨ ਜਲੇਬੀ ਖਾਜਾ ਸੋਨ ਪਾਪੜੀ ਪਤੀਸਾ ਸੋਨ ਪਾਪੜੀ ਛੀਨਾ ਖੀਰ ਲੱਡੂ ਜਲੇਬੀ ਗਾਜਰ ਕਾ ਹਲਵਾ ਲੱਸੀ ਪਾਪੜ